ਨਮਸਕਾਰ ਹਾਂਜੀ ਹਾਂਜੀ ਹਾਂਜੀ ਪਾਵਰ ਫਿਟਨੈਸ ਤੋਂ ਬੋਲ ਰਹੀ ਹੈਗੀ ਮੈਂ

ਹਾਂਜੀ ਹਾਂਜੀ ਹਾਂਜੀ ਇਹ ਪਤਾ ਕੀ ਹੋ ਜਾਂਦਾ ਮੈਡਮ ਜਿਹੜੀ ਆਪਣੀ ਅੱਜ ਕੱਲ੍ਹ ਦੀ ਖੁਰਾਕ ਹੈ ਹੈ ਨਾ ਆਪਾਂ ਮਤਲਬ ਕਿ ਘਰੇ ਖਾਂਦੇ ਰਹਿੰਦੇ ਆ ਅਤੇ ਆਪਣਾ ਇੰਨਾਂ ਤੋਰਾ ਫੇਰਾ ਹੁੰਦਾ ਨਹੀਂ ਹੈ ਨਾ ਅਤੇ ਸਰੀਰਿਕ ਐਕਸਾਈਜ਼ ਵੀ ਘੱਟ ਹੁੰਦੀ ਹੈਗੀ ਉਹਦੇ ਕਰਕੇ ਮਤਲਬ ਆਪਣਾ ਸਰੀਰ ਆ ਜਿਹੜਾ ਬਿਮਾਰੀਆਂ ਵੱਲ ਵੱਧਦਾ ਜਾ ਰਿਹਾ ਹੈਗਾ ਅਤੇ ਜੇਕਰ ਤੁਸੀਂ ਮਤਲਬ ਕਿ ਆਪਣੇ ਘਰ ਦੇ ਕੰਮ ਦੇ ਨਾਲ ਨਾਲ ਥੋੜ੍ਹੀਆਂ ਬਹੁਤੀਆਂ ਐਕਸਰਸਾਈਜ਼ਾਂ ਕਰੋਗੇ ਤਾਂ ਤੁਹਾਡੀਆਂ ਬਿਮਾਰੀਆਂ ਬਿਨਾਂ ਦਵਾਈਆਂ ਤੋਂ ਮਤਲਬ ਕਿ ਠੀਕ ਹੋ ਸਕਦੀਆਂ ਨੇ ਜੇ ਤੁਸੀਂ ਸਾਡੇ ਜਿੰਮ ਦੇ ਵਿੱਚ ਵਿਜਿਟ ਕਰੋ ਅਸੀਂ ਤੁਹਾਨੂੰ ਇੱਦਾਂ ਦੀਆਂ ਤੁਹਾਡੀ ਅਕੋਰਡਿੰਗ ਤੁਹਾਡੀ ਏਜ ਅਸੀਂ ਇੱਦਾਂ ਦੀ ਐਕਸਰਸਾਈਜ਼ ਕਰਾਵਾਂਗੇ ਕਿ ਤੁਹਾਨੂੰ ਦਵਾਈ ਖਾਣ ਦੀ ਕੋਈ ਨੋਬਤ ਨਹੀਂ ਆਏਗੀ ਮੈਂ ਤੁਹਾਨੂੰ ਕਹਿ ਰਹੀ ਆ ਨਾ ਜੀ ਹਾਂਜੀ ਹਾਂਜੀ ਇਸੇ ਕਰਕੇ ਕਹਿ ਰਹੇ ਹਾਂ ਨਾ ਤੁਸੀਂ ਸਾਡੇ ਮਤਲਬ ਕਿ ਜੇ ਤੁਸੀਂ ਸਾਡੇ ਜਿਮ ਦੇ ਵਿੱਚ ਆਓਗੇ ਤਾਂ ਤੁਸੀਂ ਮਤਲਬ ਜੇ ਤੁਸੀਂ ਐਕਸਰਸਾਈਜ਼ ਪ੍ਰੋਪਰਲੀ ਕਰੋਗੇ ਅਤੇ ਡਾਇਟ ਪ੍ਰੋਪਰ ਲਉਗੇ ਨਾ ਆਪਣੀ ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਸਾਡੇ ਸਰੀਰ ਨੂੰ ਡਾਇਟ ਦੇ ਨਾਲ ਨਾਲ ਐਕਸਰਸਾਈਜ਼ ਦੀ ਵੀ ਲੋੜ ਆ ਤਾਂ ਤੁਹਾਨੂੰ ਇਹ ਜਿਹੜੀਆਂ ਛੋਟੀਆਂ ਮੋਟੀਆਂ ਦਿੱਕਤਾਂ ਆਉਂਦੀਆਂ ਨੇ ਚਾਹੇ ਤੁਹਾਡੇ ਸਰੀਰ ਦੁੱਖਦਾ ਚਾਹੇ ਤੁਹਾਨੂੰ ਸਰਵਾਈਕਲ ਹੈ ਚਾਹੇ ਥਾਇਰਡ ਆ ਇਹ ਸਾਰੀਆਂ ਬਿਮਾਰੀਆਂ ਆਪਣੇ ਜਿਮ ਦੇ ਨਾਲ ਠੀਕ ਹੋ ਜਾਂਦੀਆਂ ਨੇ ਮੈਡਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਹਾਂਜੀ ਹਾਂਜੀ ਮੈਡਮ ਤੁਸੀਂ ਸਲਾਹ ਹੀ ਨਾ ਲਓ ਤੁਸੀਂ ਇੱਕ ਵਾਰੀ ਸਾਡਾ ਜਿੰਮ ਜੁਆਇਨ ਕਰਕੇ ਦੇਖੋ ਤੁਸੀਂ ਹਫਤੇ ਦੇ ਵਿੱਚ ਤੁਹਾਨੂੰ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਕਿ ਤੁਹਾਨੂੰ ਆਪਣਾ ਸਰੀਰ ਜਿਹੜਾ ਹਲਕਾ ਹਲਕਾ ਫੀਲ ਹੋਣਾ ਸ਼ੁਰੂ ਹੋ ਜਾਏਗਾ ਅਤੇ ਆ ਜਿਹੜੀ ਤੁਹਾਡੀ ਲੱਤਾਂ ਬਾਹਵਾਂ ਦੁੱਖਦੀਆਂ ਨੇ ਇਹ ਸਾਰੀ ਬਿਮਾਰੀ ਤੁਹਾਡੀਆਂ ਦੂਰ ਹੋ ਜਾਣਗੀਆਂ ਮੈਡਮ ਹਾਂਜੀ ਸਾਡੇ ਕੋਲ ਸਵੇਰ ਦਾ ਬੈਚ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਸਵੇਰ ਦਾ ਸਲੋਟ ਵੀ ਹੈ ਜੀ ਸਾਡੇ ਕੋਲ ਸ਼ਾਮ ਦਾ ਸਲੋਟ ਵੀ ਆ ਜੇਕਰ ਤੁਹਾਨੂੰ ਸਵੇਰ ਦਾ ਟਾਈਮ ਨਹੀਂ ਸੈਟ ਬੈਠਦਾ ਤੁਸੀਂ ਸ਼ਾਮ ਸਾਡੇ ਕੋਲ ਸ਼ਾਮ ਨੂੰ ਆ ਸਕਦੇ ਹੋ ਜੀ ਕੋਈ ਇੱਦਾਂ ਦੀ ਸਾਡੇ ਕੋਲ ਬਹੁਤ ਸਾਰੇ ਤੁਹਾਡੀਆਂ ਦਵਾਈਆਂ ਬਿਲਕੁਲ ਛੁੱਟ ਜਾਣਗੀਆਂ ਜੀ ਦਵਾਈ ਤਾਂ ਸਾਡੇ ਕੋਲ ਬਹੁਤ ਇੱਦਾਂ ਦੇ ਕੇਸਸ ਆਉਂਦੇ ਨੇ ਜਿਹੜੀਆਂ ਲੇਡੀਜ਼ ਆ ਸਾਨੂੰ ਕਹਿੰਦੀਆਂ ਨੇ ਕਿ ਹਾਂ ਸਾਨੂੰ ਆਹ ਆਹ ਦਿੱਕਤਾਂ ਸੀਗੀਆਂ ਅਤੇ ਹੁਣ ਅਸੀਂ ਬਿਲਕੁਲ ਫਿਟ ਹਾਂ ਅਤੇ ਸਾਡੀਆਂ ਦਵਾਈਆਂ ਵੀ ਛੁੱਟ ਗਈਆ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਅਤੇ ਉਹਦੇ ਨਾਲ ਵੀ ਤੁਹਾਨੂੰ ਮਤਲਬ ਕਿ ਹੋਰ ਤੁਹਾਡਾ ਮਨ ਕਰੇਗਾ ਕੀ ਅਸੀਂ ਵੀ ਆਪਾਂ ਵੀ ਫਿਟ ਰਹਿਣ ਲਈ ਅਸੀਂ ਐਕਸਾਈਜ ਵੀ ਅਤੇ ਡਾਈਟ ਵੀ ਸਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਤੰਦਰੁਸਤ ਹੋ ਕੇ ਇੱਥੋਂ ਜਾਓਗੇ ਜੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਸਾਡੇ ਕੋਲ ਸਿਕਸਟੀ ਪਲੱਸ ਲੋਕ ਵੀ ਆਉਂਦੇ ਨੇ ਜੋ ਐਕਸਸਾਈਜ਼ ਕਰਦੇ ਨੇ ਤੇ ਬਿਲਕੁਲ ਫਿਟ ਰਹਿੰਦੇ ਨੇ ਅਸੀਂ ਅਕੋਰਡਿੰਗ ਟੂ ਏਜ਼ ਆਪਣੇ ਐਕਸਾਈਜ ਕਰਵਾਉਂਦੇ ਆ ਨਾ ਜਿੱਦਾਂ ਦੀ ਤੁਹਾਡੇ ਸਰੀਰ ਨੂੰ ਨੀਡ ਹੋਏਗੀ ਉੱਦਾਂ ਦੀ ਅਸੀਂ ਐਕਸਾਈਜ ਤੁਹਾਨੂੰ ਦੱਸਾਂਗੇ ਜੀ ਤੁਸੀਂ ਸਾਡੇ ਇੱਕ ਵਾਰੀ ਜਿੰਮ 'ਚ ਆਓ ਸੈਰ ਦੇ ਨਾਲ ਨਾਲ ਥੋੜ੍ਹੀਆਂ ਬਹੁਤੀਆਂ ਐਕਸਰਸਾਈਜ਼ਾਂ ਵੀ ਇੱਦਾਂ ਦੀਆਂ ਹੁੰਦੀਆਂ ਨੇ ਕਿ ਜੋ ਆਪਣੇ ਸਰੀਰ ਨੂੰ ਫਿਟ ਰੱਖਣ ਲਈ ਜ਼ਰੂਰੀ ਹੁੰਦੀਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਸਾਡੇ ਫਿਟਨੈਂਸ ਸੈਂਟਰ ਆਓ ਅਤੇ ਜੁਆਇੰਨ ਕਰਕੇ ਹਫਤਾ ਲਾ ਕੇ ਦੇਖੋ ਹਾਂਜੀ ਨਹੀਂ ਜੀ ਆਪਾਂ ਨੇ ਸਰੀਰ ਨੂੰ ਫਿਟ ਰੱਖਣ ਲਈ ਟਾਈਮ ਤਾਂ ਜੀ ਕੱਢਣਾ ਹੀ ਪੈਂਦਾ ਇਹ ਤਾਂ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਬਿਮਾਰ ਹੁੰਦੇ ਫਿਰ ਵੀ ਤਾਂ ਆਪਾਂ ਆਪਣੇ ਘਰ ਦੇ ਘਰ ਛੱਡ ਘਰਦੇ ਕੰਮ ਛੱਡਦੇ ਆ ਨਾ ਜੀ ਜੇ ਇੱਕ ਘੰਟਾ ਆਪਾਂ ਆਪਣੇ ਸਰੀਰ ਨੂੰ ਦਈਏ ਤਾਂ ਹੈ ਨਾ ਅਤੇ ਬੰਦਾ ਫਿਟ ਰਹਿ ਸਕਦਾ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਤੁਸੀਂ ਸਾਡੇ ਜਿੰਮ ਦੇ ਵਿੱਚ ਆ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਡੇ ਜਿਮ ਦੇ ਵਿੱਚ ਜਦ ਮਰਜ਼ੀ ਆ ਸਕਦੇ ਹੋ ਸਵੇਰੇ ਛੇ ਵਜੇ ਤੋਂ ਲੈ ਕੇ ਨੌਂ ਵਜੇ ਤੱਕ ਸਾਡਾ ਜਿੰਮ ਓਪਨ ਹੁੰਦਾ ਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਓਕੇ ਜੀ ਓਕੇ